ਪੰਜਾਬ ਦੀਆਂ ਰਿਵਾਇਤੀ ਰਿਹਾਇਸ਼ੀ ਜਿਵੇਂ ਕਿ ਮਹਿਲ ਮੰਦਰ ਅਤੇ ਘਰਾਂ ਦੀਆਂ ਬਹੁਤ ਹੀ ਬਹੁਤ ਹੀ ਬਹੁਤ ਹੀ ਵਿਸ਼ੇਸ਼ਤਾਵਾਂ ਹਨ ਉਸ ਸਮੇਂ ਦੇ ਵਿੱਚ ਘਰ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਜਾਂਦੇ ਸਨ ਭਾਵੇਂ ਕਿ ਘਰ ਘਰ ਕੱਚੇ ਹੁੰਦੇ ਸਨ ਪਰ ਉਹਨਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਲਿਪਾਈ ਪਤਾਈ ਕਰਾ ਕਰਕੇ ਬਣਾਇਆ ਜਾਂਦਾ ਸੀ ਅਤੇ ਪਿੰਡਾਂ ਦੀਆਂ ਔਰਤਾਂ ਹੀ ਉਹਨਾਂ ਘਰਾਂ ਨੂੰ ਲਿੱਪ ਸਵਾਰ ਕੇ ਰੱਖਦੀਆਂ ਸਨ ਜੇਕਰ ਮੈਂ ਗੱਲ ਕਰਾਂ ਮੰਦਰਾਂ ਦੀ ਤਾਂ ਮੰਦਰ ਵੀ ਬਹੁਤ ਹੀ ਸੋਹਣੇ ਢੰਗ ਨਾਲ ਬਣਾਏ ਜਾਂਦੇ ਸਨ ਅਤੇ ਅੱਜ ਵੀ ਉਹ ਮੰਦਰ ਮੌਜੂਦ ਹਨ ਅਤੇ ਉਹਨਾਂ ਮੰਦਰਾਂ ਵਿੱਚ ਬਣਾਈਆਂ ਹੋਈਆਂ ਮੂਰਤੀਆਂ ਆਰਕੀਟੈਕਚਰ ਨੂੰ ਪ੍ਰਭਾ ਪ੍ਰਭਾਵਿਤ ਕਰਦੀਆਂ ਹਨ ਅਤੇ ਉਹਨਾਂ ਦੇ ਨਮੂਨੇ ਅੱਜ ਵੀ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ਅਤੇ ਮਹਿਲਾਂ ਦੀ ਗੱਲ ਗੱਲ ਤਾਂ ਬਹੁਤ ਹੀ ਖੂਬਸੂਰਤ ਹੈ ਉਸ ਸਮੇਂ ਬਹੁਤ ਸਾਰੇ ਸੁੰਦਰ ਭਵਨ ਜਾਂ ਮਹਿਲ ਉਸਾਰੇ ਜਾਂਦੇ ਸ ਉਸਾਰੇ ਜਾਂਦੇ ਸਨ ਅਤੇ ਉਹਨਾਂ ਮਹਿਲਾਂ ਜਾਂ ਮਹਿਲਾਂ ਜਾਂ ਘਰਾਣਿਆਂ ਦੇ ਵਿੱਚ ਰ ਰਾਜੇ ਰਾਜ ਕਰਿਆ ਕਰਦੇ ਸਨ ਅਤੇ ਉਹ ਉਹਨਾਂ ਮਹਿਲਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਉਣ ਦੇ ਲਈ ਬਹੁਤ ਸਾਰੀਆਂ ਮੂਰਤੀ ਮੂਰਤੀਆਂ ਅਤੇ ਸਾਹਿਤ ਦਾ ਨਿਰਮਾਣ ਕਰਦੇ ਸਨ ਜੋ ਅੱਜ ਵੀ ਜੋ ਅੱਜ ਵੀ ਅਜਾਇਬ ਘਰਾਂ ਵਿੱਚ ਜਾਂ ਮਹਿਲਾਂ ਦੇ ਮਹਿਲਾਂ ਦੇ ਰੂਪ ਵਿੱਚ ਪ੍ਰ ਪ੍ਰਮਾਣਿਤ ਹਨ ਜਿਵੇਂ ਕਿ ਅੱਜ ਜਿਵੇਂ ਕਿ ਤਾਜ ਮਹਿਲ ਇੱਕ ਬਹੁਤ ਹੀ ਉਦਾ ਵਧੀਆ ਉਦਾਹਰਣ ਹੈ ਜਿਸ ਉੱਤੇ ਕਲਾਕ੍ਰਿਤੀਆਂ ਦੀ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਸਾਹਿਤ ਵਿਦਵਾਨਾਂ ਦੁਆਰਾ ਜਾਂ ਫਿਰ ਆਰਕੀਟੈਕਚਰਾ ਦੁਆਰਾ ਰਚਨਾ ਕੀਤੀ ਗਈ ਹੈ